ਸਰੋਤਾਂ ਦੀ ਘਾਟ ਨੇ ਸਾਡੇ ਖੇਤਰ ਨੂੰ ਬਹੁਤ ਹੀ ਜ਼ਿਆਦੇ ਪ੍ਰਭਾਵਿਤ ਕੀਤਾ ਹੈ ਜੇਕਰ ਨੈਗੇਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਨੈਗੇਟਿਵਿਟੀ ਦੇ ਨਜ਼ਰ ਨਾਲ ਦੇਖਿਆ ਜਾਵੇ ਤਾਂ ਉਹ ਬਹੁਤ ਹੀ ਘੱਟ ਸਾਡੇ ਕੋਲ ਸੋਰਸਿਸ ਹੈ ਜਿਸ ਨਾਲ ਕਿ ਅਸੀਂ ਆਪਣਾ ਇਲਾਜ ਕਰਵਾ ਸਕਦੇ ਹਾਂ ਜਿਸ ਵਿੱਚ ਕਿ ਸਾਨੂੰ ਟੀਕੇ ਜਾਂ ਜਾਂ ਤਾਂ ਫੇਰ ਟੀਕਾਕਰਨ ਕੇਂਦਰ ਵੀ ਨਹੀਂ ਮਿਲ ਪਾਉਂਦੇ